ਭਾਰਤ ਵਿੱਚ ਪਿੰਡ ਮਿਰਜਾਪੁਰ ਜ਼ਿਲ੍ਹਾਂ ਪਠਾਨਕੋਟ ਦਾ ਰਹਿਣ ਵਾਲਾ ਅਤੇ ਮੇਰੇ ਪਸੰਦੀ ਦੇ ਗਾਣੇ ਪੰਜਾਬੀ ਗਾਣੇ ਨੇ ਅਤੇ ਮੈ ਅਕਸਰ ਹੀ ਟੀ ਵੀ ਲਗਾ ਕੇ ਹੈਡਫੋਨ ਲਗਾ ਕੇ ਇਹਨਾਂ ਦੇ ਗਾਣੇ ਸੁਣਦਾ ਰਹਿੰਦਾ ਜਿਨ੍ਹਾਂ ਵਿੱਚੋਂ ਅੰਮ੍ਰਿਤ ਮਾਨ ਅਮ੍ਰਿਤ ਮਾਨ ਹੋ ਗਿਆ ਆਰਨੇਤ ਹੋ ਗਿਆ ਜੈਜੀ ਬੀ ਹੋ ਗਿਆ ਅਤੇ ਨਾਲ ਦੀ ਨਾਲ ਕਾਫ਼ੀ ਫੇਮਸ ਐਕਟਰਸ ਜਿਹਨਾਂ ਦੇ ਸੋਂਗ ਗਾਉਂਦੇ ਆ ਉਹਨਾਂ ਦੇ ਗਾਣੇ ਸੁਣਦਾ ਰਹਿੰਦਾ ਮੈਨੂੰ ਬਹੁਤ ਵਧੀਆ ਲੱਗਦਾ ਅਤੇ ਮੈਂ ਹੈਡਫੋਨ ਲਗਾ ਕੇ ਇਹ ਗਾਣੇ ਸੁਣਦਾ ਅਤੇ ਬਹੁਤ ਵਧੀਆ ਲੱਗਦਾ ਇਹਨਾਂ ਦੇ ਗਾਣੇ ਪੰਜਾਬੀ ਗਾਣੇ ਹੁੰਦੇ ਆ ਅਤੇ ਪੰਜਾਬੀ ਗਾਣੇ ਅਕਸਰ ਹੀ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਗਾਏ ਅਤੇ ਸੁਣੇ ਜਾਂਦੇ ਹਨ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਦੇ ਗਾਣਿਆ ਦਾ ਅਤੇ ਇਹ ਗਾਣੇ ਮੈਂ ਜ਼ਿਆਦਾਤਰ ਆਪ ਇਕੱਲੇ ਬਹਿ ਕੇ ਸੁਣਦਾ ਹਾਂ ਕਿਉਂਕਿ ਸ਼ੋਰ ਸ਼ਰਾਬੇ ਵਿੱਚ ਇਹ ਗਾਣੇ ਸੁਣਨੇ ਅੱਛੇ ਨਹੀਂ ਲੱਗਦੇ ਕਿਉਂਕਿ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਗਾਣੇ ਤਾਂ ਇਹ ਇਕੱਲੇ ਬਹਿ ਕੇ ਹੈਡਫੋਨ ਲਗਾ ਕੇ ਹੀ ਗਾਣੇ ਸੁਣਨਾ ਮੈਂ ਪਸੰਦ ਕਰਦਾ ਹਾਂ ਧੰਨਵਾਦ ਜੀ